ਹੈਲੋ ਸਤਿ ਸ਼੍ਰੀ ਅਕਾਲ ਤੁਸੀਂ ਸੂਟਾਂ ਵਾਲੀ ਦੁਕਾਨ ਤੋਂ ਬੋਲਦੇ ਮੈਂ ਸੂਟ ਲੈਣੇ ਸੀ ਮਾਸੀ ਦੀ ਕੁੜੀ ਦਾ ਵਿਆਹ ਸੀ ਦਸ ਬਾਰਾਂ ਸੂਟ ਲੈਣੇ ਤੁਸੀਂ ਰੇਟ ਦੱਸੋਗੇ ਤਿੰਨ ਹਜ਼ਾਰ ਤੋਂ ਘੱਟ ਨਹੀਂ ਹੋਏਗਾ ਪਹਿਲੀ ਵਾਰ ਸੂਟ ਲੈਣੇ ਆਂ ਤੁਹਾਡੇ ਤੋਂ ਥੋੜ੍ਹਾ ਜਿਹਾ ਤਾਂ ਘੱਟ ਕਰੋ ਦੱਸ ਬਾਰਾਂ ਸੂਟ ਲੈਣੇ ਨੇ ਅਤੇ ਥੋੜ੍ਹਾ ਘੱਟ ਚਾਹੀਦਾ ਜਿਵੇਂ ਤਿੰਨ ਹਜ਼ਾਰ ਦਾ ਦੋ ਹਜ਼ਾਰ ਦਾ ਕਰ ਦਿਉ ਨਹੀਂ ਨਹੀਂ ਦੋ ਹਜ਼ਾਰ ਠੀਕ ਆ ਦਸ ਬਾਰਾਂ ਸੂਟ ਲੈਣੇ ਨਹੀਂ ਨਹੀਂ ਭੈਣ ਜੀ ਠੀਕ ਆ ਦਸ ਬਾਰਾਂ ਸੂਟ ਲੈਣੇ ਨੇ ਦੋ ਹਜ਼ਾਰ ਦਾ ਰੇਟ ਠੀਕ ਆ ਹਾਂਜੀ ਨਹੀਂ ਨਹੀਂ ਭੈਣ ਜੀ ਦੋ ਹਜ਼ਾਰ ਠੀਕ ਆ ਦੋ ਹਜ਼ਾਰ ਦੇ ਠੀਕ ਨੇ ਫਿਰ ਅਸੀਂ ਦੁਬਾਰਾ ਵੀ ਤਾਂ ਆ ਸਕਦੇ ਹਾਂ ਨਾ ਇਸ ਤਰ੍ਹਾਂ ਫਿਰ

ਨਹੀਂ ਨਹੀਂ ਭੈਣ ਜੀ ਦੋ ਹਜ਼ਾਰ ਤੱਕ ਠੀਕ ਆ ਸਾਡੀ ਰੇਂਜ਼ ਇੰਨੀ ਤੱਕ ਹੀ ਆ ਭੈਣ ਦੋ ਹਜ਼ਾਰ ਦਸ ਬਾਰਾਂ ਸੂਟ ਲੈਣੇ ਨੇ ਥੋੜ੍ਹਾ ਖੁਦ ਵੀ ਦੇਖੋ ਨਾ ਦੋ ਹਜ਼ਾਰ ਤੱਕ ਠੀਕ ਹੈ ਨਹੀਂ ਨਹੀਂ ਭੈਣ ਜੀ ਇੱਦਾਂ ਥੋੜ੍ਹੀ ਚੱਲਦਾ